ਜਿਵੇਂ ਕਿ ਮੈਂ ਦੱਸਿਆ ਮੈਨੂੰ ਖਾਣਾ ਬਣ ਬਣਾਉਣਾ ਬਹੁਤ ਪਸੰਦ ਆ ਮੈਂ ਕਾਫੀ ਛੋਟੀ ਉਮਰ ਤੋਂ ਹੀ ਖਾਣਾ ਬਣਾਉਂਦੀ ਆ ਰਹੀ ਹਾਂ ਮੈਂ ਪਹਿਲਾਂ ਆਪਣੀ ਮੰਮੀ ਨੂੰ ਖਾਣਾ ਬਣਾਉਂਦੇ ਹੋਏ ਦੇਖਿਆ ਅਤੇ ਹੁਣ ਜਿਵੇਂ ਮੈਂ ਵੱਡੀ ਹੋ ਚੁੱਕੀ ਹਾਂ ਮੈਂ ਵੀ ਖਾਣਾ ਬਣਾਉਂਦੀ ਹਾਂ ਮੈਂ ਉਹਨਾਂ ਦੀ ਮਦਦ ਵੀ ਕਰਦੀ ਅਤੇ ਖੁਦ ਵੀ ਉਹ ਕਰਦੀ ਹਾਂ ਆਪਾਂ ਖਾਣਾ ਬਣਾਲ ਬਣਾਉਂਦੇ ਹਾਂ ਗੈਸ 'ਤੇ ਗੈਸ ਕਿਹਦੇ ਨਾਲ ਚੱਲਦਾ ਐੱਲ ਪੀ ਜੀ ਸਿਲੰਡਰ ਦੇ ਵਿੱਚ ਉਹਦੇ ਵਿੱਚ ਗੈਸ ਹੁੰਦੀ ਹੈ ਜੋ ਬਹੁਤ ਹੀ ਵਧੀਆ ਗੈਸ ਹੈ ਜਿਸ ਕਰਕੇ ਆਪਾਂ ਘਰ ਵਿੱਚ ਅੰਦਰ ਬੈਠੇ ਖਾਣਾ ਬਣਾ ਸਕਦੇ ਹਾਂ ਪਰ ਉਹ ਗੈਸ ਖਤਰਨਾਕ ਅਤੇ ਜ਼ਹਿਰੀਲੀ ਵੀ ਬਹੁਤ ਹੈ ਜਿਸ ਕਰਕੇ ਸਾਨੂੰ ਕਾਫੀ ਸਾਰੀ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ ਜਾਂ ਸਾਨੂੰ ਵਰਤਣੀਆਂ ਚਾਹੀਦੀਆਂ ਹਨ ਅਗਰ ਆਪਾਂ ਉਹੀ ਯੂਜ਼ ਕਰ ਰਹੇ ਹਾਂ ਵੈਸੇ ਲੋਕ ਇਹਨਾਂ ਦਾ ਇੰਨਾ ਧਿਆਨ ਨਹੀਂ ਕਰਦੇ ਸਭ ਨੂੰ ਪਰ ਕਰਨਾ ਚਾਹੀਦਾ ਹੈ ਐੱਲ ਪੀ ਜੀ ਬਹੁਤ ਖਤਰਨਾਕ ਗੈਸ ਆ ਅਗਰ ਉਹ ਲੀਕ ਹੋ ਜਾਵੇ ਜਾਂ ਕੁਝ ਵੀ ਹੋ ਜਾਵੇ ਤਾਂ ਘਰ ਦੇ ਵਿੱਚ ਬਲਾਸਟ ਵੀ ਹੋ ਸਕਦਾ ਜਿਸ ਕਰਕੇ ਉਸ ਘਰ ਵਾਲਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਇਹ ਤਾਂ ਆਪਾਂ ਕਾਫੀ ਵਾਰ ਖਬਰਾਂ ਵਿੱਚ ਵੀ ਸੁਣਦੇ ਹਾਂ ਕਿ ਕਿਤੇ ਐੱਲ ਪੀ ਜੀ ਸਿਲੰਡਰ ਫਟ ਗਿਆ ਜਿਸ ਨਾਲ਼ ਕਾਫੀ ਬਲਾਸਟ ਹੋਇਆ ਕਿਸੇ ਦੀ ਮੌਤ ਹੋ ਗਈ ਇਹੋ ਜਿਹੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਫਿਰ ਵੀ ਲੋਕ ਇਹਦੀਆਂ ਸਾਵਧਾਨੀਆਂ ਨਹੀਂ ਵਰਤਦੇ ਜਾ ਕੇ ਉਹਨਾਂ ਨੂੰ ਵਰਤਣੀਆਂ ਚਾਹੀਦੀਆਂ ਸਾਵਧਾਨੀਆਂ ਕਿਵੇਂ ਸਾਵਧਾਨੀਆਂ ਜ਼ਿਆਦਾ ਵੱਡੀਆਂ ਨਹੀਂ ਹੈ ਛੋਟੀਆਂ ਛੋਟੀਆਂ ਏ ਜੋ ਸਾਨੂੰ ਵਰਤਣੀਆਂ ਚਾਹੀਦੀਆਂ ਜਿਵੇਂ ਆਪਾਂ ਖਾਣਾ ਬਣਾ ਰਹੇ ਸਾਨੂੰ ਚੈੱਕ ਕਰਨਾ ਚਾਹੀਦਾ ਜੋ ਪਾਈਪ ਹੈ ਸਿਲੰਡਰ ਵਾਲੀ ਉਹ ਪ੍ਰੋਪਰ ਚੱਜ ਨਾਲ ਗੈਸ ਨਾਲ ਲੱਗੀ ਹੋਈ ਹੈ ਜਾਂ ਨਹੀਂ ਅਗਰ ਨਹੀਂ ਲੱਗੀ ਹੋਈ ਤਾਂ ਸਾਨੂੰ ਖਾਣਾ ਬਣਾਉਣ ਟਾਈਮ ਦੇਖਣਾ ਚਾਹੀਦਾ ਕਿ ਨਹੀਂ ਲੱਗੀ ਹੋਈ ਤਾਂ ਸਾਨੂੰ ਉਹ ਨਾਲ ਪ੍ਰੋਪਰ ਅਟੈਚ ਕਰਨਾ ਚਾਹੀਦਾ ਸਾਨੂੰ ਥੱਲੇ ਐੱਲ ਪੀ ਜੀ ਵਿੱਚ ਦੇਖਣਾ ਚਾਹੀਦਾ ਕਿ ਪ੍ਰੋਪਰ ਗੈਸ ਹੈ ਜੋ ਉਹ ਪ੍ਰੋਪਰ ਆ ਰਹੀ ਆ ਯਾ ਲੀਕ ਤਾਂ ਨਹੀਂ ਹੋ ਰਹੀ ਅਗਰ ਲੀਕ ਹੋ ਰਹੀ ਹੈ ਤਾਂ ਸਾਨੂੰ ਉਹਨੂੰ ਬੰਦ ਕਰਕੇ ਵਾਪਸ ਰੱਖ ਕੇ ਜਿੱਥੋਂ ਆਪਾਂ ਲੈ ਕੇ ਆਏ ਸੀ ਗੈਸ ਏਜੰਸੀ ਉੱਥੇ ਵਾਪਸ ਕਰਨਾ ਚਾਹੀਦਾ ਹੈ ਅਗਰ ਆਪਾਂ ਖਾਣਾ ਬਣਾਉਣ ਤੋਂ ਬਾਅਦ ਵਿੱਚ ਰਾਤ ਨੂੰ ਸੌਣ ਤੋਂ ਪਹਿਲਾਂ ਕੋਈ ਵੀ ਇਹ ਕੰਮ ਨਹੀਂ ਕਰਦਾ ਜੋ ਕਰਨਾ ਚਾਹੀਦਾ ਚੈੱਕ ਕਰਨਾ ਚਾਹੀਦਾ ਕਿ ਐੱਲ ਪੀ ਜੀ ਸਿਲੰਡਰ ਉਹਨੂੰ ਬੰਦ ਕਰਕੇ ਸੌਵੋ ਯਾਂ ਦੇਖੋ ਕਿ ਪ੍ਰੋਪਰ ਚੱਜ ਨਾਲ ਅਟੈਚ ਹੈ ਜਾਂ ਨਹੀਂ ਹੈ ਅਤੇ ਹੋਰ ਸਾਵਧਾਨੀ ਇਹ ਹੋ ਸਕਦੀ ਹੈ ਕਿ ਜੋ ਘਰ ਵਿੱਚ ਛੋਟੇ ਬੱਚੇ ਹਨ ਉਹਨਾਂ ਨੂੰ ਉਸ ਐੱਲ ਪੀ ਜੀ ਸਿਲੰਡਰ ਦੇ ਕੋਲ ਬਿਲਕੁਲ ਨਹੀਂ ਆਉਣ ਦੇਣਾ ਚਾਹੀਦਾ ਉਹਨਾਂ ਨੂੰ ਉਸ ਤੋਂ ਦੂਰ ਰੱਖਣਾ ਚਾਹੀਦਾ ਕਿਉਂਕਿ ਇਹ ਬੱਚਿਆਂ ਦੀ ਖੇਡਣ ਵਾਲੀ ਚੀਜ਼ ਨਹੀਂ ਸਾਨੂੰ ਨਹੀਂ ਪਤਾ ਉਹ ਛੋਟਾ ਬੱਚਾ ਉਹਨੂੰ ਉਹਨੂੰ ਸਮਝ ਨਹੀਂ ਹੈ ਕੁਝ ਇੱਦਾਂ ਦਾ ਕਰਦੇ ਜਿਸ ਨਾਲ ਗੈਸ ਲੀਕ ਹੋ ਜਾਵੇ ਜਿਸ ਨਾਲ ਸਾਡਾ ਹੀ ਨੁਕਸਾਨ ਹੋਵੇਗਾ ਅਤੇ ਅਗਰ ਆਪਾਂ ਗੈਸ ਲੈਣ ਜਾਂਦੇ ਹਾਂ ਸਿਲੰਡਰ ਲੈਣ ਜਾਂਦੇ ਹਾਂ ਐੱਲ ਪੀ ਜੀ ਦਾ ਆਪਾਂ ਉਹ ਚੱਕਿਆ ਅਗਰ ਸਾਨੂੰ ਲੱਗਦਾ ਉਹ ਗੈਸ ਲੀਕ ਹੋ ਰਿਹਾ ਅਣਗੈਲੀ ਨਾ ਕਰਕੇ ਉਸਨੂੰ ਉਦੋਂ ਹੀ ਜਾ ਕੇ ਸਿਲੰਡਰ ਵਾਲੀ ਕੰਪਨੀ ਨੂੰ ਵਾਪਸ ਕੀਤ ਕਰ ਦ ਦਈਏ ਸੋ ਕਿ ਉਹ ਲੀਕ ਹੋ ਰਿਹਾ ਆਪਾਂ ਐਕਸਚੇਂਜ ਕਰਾ ਕੇ ਨਵਾਂ ਲਈਏ ਜਿਸ ਨਾਲ਼ ਸਾਨੂੰ ਅੱਗੇ ਜਾ ਕੇ ਕੋਈ ਵੀ ਨੁਕਸਾਨ ਨਾ ਹੋਵੇ ਇਹ ਛੋਟੀ ਛੋਟੀਆਂ ਸਾਵਧਾਨੀਆਂ ਵਰਤ ਕੇ ਆਪਾਂ ਐੱਲ ਪੀ ਜੀ ਦਾ ਬਹੁਤ ਚੱਜ ਨਾਲ ਯੂਸ ਕਰ ਸਕਦੇ ਹਾਂ ਲੋਕਾਂ ਦੇ ਭਲੇ ਲਈ ਹੀ ਇਹ ਚੀਜ਼ ਬਣੀ ਹੈ ਅਤੇ ਬਹੁਤ ਵਧੀਆ ਚੀਜ਼ ਹੈ ਅਗਰ ਆਪਾਂ ਇਹ ਸਾਵਧਾਨੀਆਂ ਵਰਤਾਂਗੇ ਤਾਂ ਇਸ ਨਾਲ਼ ਸਾਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਅਤੇ ਸਾਡਾ ਹੀ ਫਾਇਦਾ ਹੈ ਤੇ ਸਭ ਦਾ ਫਾਇਦਾ ਹੋਵੇਗਾ